ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਜਾਂ ਪ੍ਰਾਈਵੇਟ ਕਲਾਸ ਜਿਸ ਨੂੰ ਆਪਾਂ ਕਹਿੰਦੇ ਹਾਂ ਉਹਦੇ ਬਾਰੇ ਮੇਰੇ ਇਹ ਵਿਚਾਰ ਆ ਕਿ ਸਾਨੂੰ ਉਹ ਚੀਜ਼ ਜ਼ਰੂਰ ਕਰਨੀ ਚਾਹੀਦੀ ਹੈ ਜਿਵੇਂ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਬੱਚਿਆਂ ਦਾ ਤਾਂ ਬੱਚੇ ਅਗਰ ਸਵੇਰੇ ਸਕੂਲ ਜਾ ਰਹੇ ਨੇ ਸ਼ਾਮੀ ਘਰ ਆ ਕੇ ਇੱਧਰ ਉੱਧਰ ਘੁੰਮ ਰਹੇ ਨੇ ਅਤੇ ਉਹ ਕੀ ਕਰ ਰਹੇ ਨੇ ਆਪਣਾ ਲੂਸ ਲੋਸ ਕਰ ਰਹੇ ਨੇ ਇੰਟਰਸਟ ਪੜ੍ਹਾਈ ਲਿਖਾਈ ਵਿੱਚ ਜਦੋਂ ਕਿ ਉਹ ਇਹੀ ਜੇ ਉਹ ਟਿਊਸ਼ਨ ਜਾਣਗੇ ਜਾਂ ਘਰ ਵਿੱਚ ਹੀ ਰਹਿ ਕੇ ਉਹ ਪ੍ਰੈਕਟਿਸ ਕਰਨਗੇ ਦਿੱਤੇ ਹੋਏ ਕੰਮ ਦੀ ਤਾਂ ਉਹ ਅੱਗੇ ਅੱਗੇ ਵੱਧਣਗੇ ਐਵੇਂ ਹੀ ਆਪਾਂ ਜੇਕਰ ਸਕੂਲ ਵਿੱਚ ਕੋਈ ਵੀ ਕੰਮ ਕੀਤਾ ਤਾਂ ਆਪਾਂ ਉਹਨੂੰ ਸ਼ਾਮ ਦੀ ਟਿਊਸ਼ਨ 'ਤੇ ਜਾ ਕੇ ਉਹਦਾ ਅਭਿਆਸ ਕਰ ਰਹੇ ਨੇ ਨਿਰੰਤਰ ਅਭਿਆਸ ਕਰ ਰਹੇ ਹਾਂ ਵਧੀਆ ਤਰੀਕੇ ਨਾਲ ਅਤੇ ਸਾਨੂੰ ਅੱਗੇ ਜਾ ਕੇ ਕਾਫ਼ੀ ਮਦਦ ਕਰਦੀ ਹੈ ਅਸੀਂ ਕੁਝ ਐਕਸਟਰਾ ਸਿੱਖ ਪਾਉਂਦੇ ਹਾਂ ਅਲੱਗ ਅਲੱਗ ਪੜ੍ਹਾਈ ਦੇ ਜਿਹੜੀ ਆਪਾਂ ਸਕੂਲੇ ਪੜ੍ਹਾਈ ਕਰ ਰਹੇ ਹਾਂ ਉਹ ਤਾਂ ਆਪਾਂ ਸਿੱਖ ਹੀ ਰਹੇ ਹਾਂ ਪਰ ਆਪਾਂ ਟਿਊਸ਼ਨ ਵਗੈਰਾ ਜਾ ਕੇ ਕੁਝ ਅਲੱਗ ਸਿੱਖਦੇ ਹਾਂ ਆਪਾਂ ਵਧੀਆ ਵਧੀਆ ਕੋਰਸਿਸ ਲੈਂਦੇ ਹਾਂ ਆਪਾਂ ਵਧੀਆ ਵਧੀਆ ਜਗ੍ਹਾ ਆਪਣੀ ਟਿਊਸ਼ਨ ਨੂੰ ਹਾਇਰ ਕਰਦੇ ਹਾਂ ਵਧੀਆ ਵਧੀਆ ਟੀਚਰ ਹਾਇਰ ਕਰਦੇ ਹਾਂ ਤਾਂ ਜੋ ਆਪਾਂ ਕੁਝ ਵਧੀਆ ਸਿੱਖ ਸਕੀਏ ਅਤੇ ਅੱਗੇ ਜਾ ਕੇ ਪੜ੍ਹਾਈ ਵਿੱਚ ਅਵੱਲ ਆ ਸਕੀਏ ਇਹ ਸਾਨੂੰ ਕਾਫ਼ੀ ਹੈਲਪ ਕਰਦਾ ਹੈ ਅਤੇ ਸਾਨੂੰ ਸਕੂਲ ਤੋਂ ਬਾਅਦ ਪਰੈਫਰ ਕਰਨਾ ਹੀ ਚਾਹੀਦਾ ਕਿ ਕੋਚਿੰਗ ਵਗੈਰਾ ਟਿਊਸ਼ਨ ਵਗੈਰਾ ਆਪਾਂ ਲਵਾਈਏ ਹੁਣ ਤੋਂ ਜੇ ਆਪਾਂ ਲਗਾਵਾਂਗੇ ਤਾਂ ਅੱਗੇ ਜਾ ਕੇ ਸਾਨੂੰ ਵਧੀਆ ਹੈਬਿਟ ਪਏਗੀ